ਹੈਲੋ ਮੀਸ਼ੋ ਤੁਸੀਂ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਅਤੇ ਮੈਂ ਰੇਖਾ ਤੁਹਾਡੇ ਮੀ ਮੈਂ ਮੀਸ਼ੋ ਐਪ 'ਤੇ ਤੁਹਾਡੇ ਔਨਲਾਈਨ ਸ਼ੋਪਿੰਗ ਵਿੱਚੋਂ ਔਨਲਾਈਨ ਸ਼ੋਪਿੰਗ ਕਰਦੀ ਹਾਂ ਅਤੇ ਮੈਂ ਬਹੁਤ ਸਾ ਬਹੁਤ ਕੁਝ ਬਹੁਤ ਸਮਾਨ ਔਨਲਾਈਨ ਖਰੀਦਿਆ ਹੈ ਬੱਟ ਮੈਨੂੰ ਇੱਕ ਚੱਪਲਾਂ ਦਾ ਜੋੜਾ ਜੋ ਕਿ ਮੈਂ ਔਨਲਾਈਨ ਖਰੀਦਿਆ ਹੈ ਮੈਨੂੰ ਡਿਲੀਵਰ ਨਹੀਂ ਹੋਇਆ ਬਹੁ ਮੇਰੇ ਓਡਰ ਲਿਸਟ ਵਿੱਚ ਮੈਨੂੰ ਡਿਲੀਵਰ ਦਿਖਾ ਰਿਹਾ ਪਰ ਮੇਰੇ ਕੋਲ ਡਿਲੀਵਰ ਨਹੀਂ ਹੋਇਆ ਅਤੇ ਇੱਕ ਚੱਪਲਾਂ ਦਾ ਜੋੜਾ ਮੈਂ ਓਡਰ ਕੀਤਾ ਸੀਗਾ ਅਤੇ ਉਹ ਮੇਰੇ ਕੋਲ ਗਲਤ ਆ ਗਿਆ ਅਤੇ ਮੈਂ ਐਕਸਚੇਂਜ ਕਰਨ ਲਈ ਅ ਰਿਕੁਐਸਟ ਭੇਜੀ ਤਾਂ ਉਹ ਮੇਰੇ ਕੋਲ ਐਕਸਚੇਂਜ ਦੀ ਓਪਸ਼ਨ 'ਤੇ ਕਲਿੱਕ ਹੋ ਦਿਖਾ ਰਿਹਾ ਵੀ ਉਹ ਐਕਸਚੇਂਜ ਹੋ ਗਿਆ ਬੱਟ ਮੇਰੇ ਕੋਲ ਉਹ ਪਹੁੰਚਿਆ ਨਹੀਂ ਅਤੇ ਐਵੇਂ ਦਿਖਾ ਰਿਹਾ ਸ਼ੋ ਕਰਾ ਰਿਹਾ ਵੀ ਉਹ ਮੇਰੇ ਕੋਲ ਪਹੁੰਚ ਚੁੱਕਾ ਬੱਟ ਮੇਰੇ ਕੋਲ ਪਹੁੰਚਿਆ ਨਹੀਂ ਤਾਂ ਪਲੀਜ਼ ਮੇਰੀ ਇਸ ਪ੍ਰੋ ਮੇਰੀ ਇਹ ਸਮੱਸਿਆ ਦਾ ਤੁਸੀਂ ਹੱਲ ਕਰੋ ਅਤੇ ਮੇਰੇ ਜੋ ਚੀਜ਼ ਮੇਰੇ ਕੋਲ ਡਿਲੀਵਰ ਨਹੀਂ ਹੋਈ ਉਹ ਚੀਜ਼ ਮੇਰੇ ਕੋਲ ਡਿਲੀਵਰ ਕਰੋ ਅਤੇ ਜਾਂ ਮੇਰਾ ਬਣਦਾ ਹੋਇਆ ਭੁਗਤਾਨ ਮੈਨੂੰ ਵਾਪਿਸ ਕਰੋ